ਹੈਲੋ ਹਾਂਜੀ ਤੁਸੀਂ ਹਰਮਨ ਦੇ ਮੰਮਾ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਉਹ ਨਾ ਅਸੀਂ ਇਹ ਦੱਸਣਾ ਸੀ ਤੁਹਾਡੇ ਬੱਚੇ ਨੂੰ ਨਾ ਮਤਲਬ ਫੀਵਰ ਹੋ ਗਿਆ ਹਾਂਜੀ ਅਤੇ ਉਹਨੂੰ ਨਾ ਠੰਡ ਜਿਹੀ ਲੱਗ ਰਹੀ ਸੀ ਅਤੇ ਅਸੀਂ ਪੁੱਛਿਆ ਕੀ ਗੱਲ ਹੋਗੀ ਅਤੇ ਉਸਨੂੰ ਦ ਦੇਖਿਆ ਲਾ ਕੇ ਕਿ ਉਸਨੂੰ ਬੁਖਾਰ ਸੀ ਅਸੀਂ ਮਤਲਬ ਮੈਮ ਠੰਡ ਕਰਕੇ ਨਾ ਬਹੁਤ ਤਾਂ ਸ਼ਾਇਦ ਇਸ ਨੂੰ ਬੁਖਾਰ ਹੋ ਗਿਆ ਅਤੇ ਅਸੀਂ ਪਤਾ ਸਕੂਲ ਦੀ ਜਿਹੜੀ ਡਿਸਪੈਂਸਰੀ ਵਗੈਰਾ ਹੁੰਦੀ ਆ ਉਥੋਂ ਅਸੀਂ ਇਹਨੂੰ ਇੱਕ ਗੋਲੀ ਵੀ ਦੇ ਤੀ ਜਿਹਦੇ ਕਰਕੇ ਇਹਦਾ ਬੁਖਾਰ ਥੋੜ੍ਹਾ ਜਿਹਾ ਘੱਟ ਹੋ ਜੇ ਪਰ ਕੋਈ ਫਰਕ ਨਹੀਂ ਪਿਆ ਇਸ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਮੈਮ ਅਸੀਂ ਉਹਨੂੰ ਇੱਕ ਸੈਂਡਵਿਚ ਦੇ ਤਾ ਸੀ ਕਿ ਖਾਲੀ ਪੇਟ ਨਾ ਦਵਾਈ ਲਏ ਅਤੇ ਉਹਨੂੰ ਅਸੀਂ ਰੈਸਟ ਕਰਨ ਲਈ ਰੂਮ 'ਚ ਹਾਂਜੀ ਅਤੇ ਅਸੀਂ ਇਸਨੂੰ ਰੂਮ 'ਚ ਪਾ ਤਾ ਸੀ ਕਿ ਇਹ ਥੋੜ੍ਹੀ ਦੇਰ ਰੈਸਟ ਕਰ ਲਏ ਕਿ ਬੁਖਾਰ ਉਤਰ ਜੇ ਪਰ ਬੁਖਾਰ ਨਹੀਂ ਉਤਰਿਆ ਇਸਨੂੰ ਬਹੁਤ ਤੇਜ਼ ਹੋ ਗਿਆ ਤੁਸੀਂ ਨਾ ਇਸ ਨੂੰ ਆ ਕੇ ਲੈ ਜਾਓ ਅਤੇ ਇਸਨੂੰ ਦ ਦਵਾਈ ਵਗੈਰਾ ਦਵਾ ਦਿਉ ਇਸਕਾ ਬੁਖਾਰ ਉਤਰਜੇਗਾ ਹਾਂਜੀ ਮੈਮ ਦੇਖੋ ਆਉਣਾ ਤਾਂ ਤੁਹਾਨੂੰ ਹੀ ਪੈਣਾ ਲੈਣ ਵਾਸਤੇ ਹੈ ਨਾ ਮੈਮ ਦੇਖੋ ਤੁਹਾਨੂੰ ਹੀ ਆਉਣਾ ਪੈਣਾ ਚਲੋ ਅਸੀਂ ਐਂ ਕਰਦੇ ਹਾਂ ਅਸੀਂ ਸਕੂਲ ਦੀ ਜਿਹੜੀ ਵੈਨ ਹੁੰਦੀ ਆ ਨਾ ਉਸ ਦੇ ਰਾਹੀਂ ਤੁਹਾਡੇ ਬੱਚੇ ਨੂੰ ਘਰ ਪਹੁੰਚਾ ਦਿੰਦੇ ਹਾਂ ਪਰ ਤੁਸੀਂ ਇਸ ਨੂੰ ਪਲੀਜ਼ ਦ ਦਵਾਈ ਦਵਾ ਦੇਣਾ ਤਾਂ ਜੋ ਇਹ ਆਪਣੀ ਕੋਈ ਵੀ ਆ ਸਕਦਾ ਬਸ ਆ ਕੇ ਇਹ ਦੱਸਣਾ ਪੈਣਾ ਕਿ ਕਿ ਥੋਨੇ ਭੇਜਿਆ ਆ ਕੇ ਕਿ ਤੁਸੀਂ ਗੱਲ ਕਰ ਲਿਓ ਸਾਡੇ ਨਾਲ ਹਾਂਜੀ ਹਾਂਜੀ ਮੈਮ ਲੈ ਜਾਣਾ ਓਕੇ ਮੈਮ ਥੈਂਕ ਯੂ ਮੈਮ ਦਸ ਪੰਦਰਾਂ ਮਿੰਟ ਹੋ ਗਏ ਦਵਾਈ ਦਿੱਤੀ ਨੂੰ ਨਹੀਂ ਮੈਮ ਨਹੀਂ ਮੈਮ ਠੀਕ ਹੈ ਮੈਮ ਓਕੇ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਮੈਮ ਓਕੇ ਹਾਂਜੀ ਓਕੇ ਮੈਮ ਥੈਂਕ ਯੂ ਹਾਂਜੀ ਹਾਂਜੀ ਠੀਕ ਹੈ ਜੀ